ਸਤਿ ਸ਼੍ਰੀ ਅਕਾਲ ਕੀ ਤੁਸੀਂ ਬਿੱਗਬੈਨ ਰੈਸਟੋਰੈਂਟ ਤੋਂ ਬੋਲ ਰਹੇ ਹੋ ਮੈਂ ਅਮਨਦੀਪ ਸਿੰਘ ਸਾਡੇ ਘਰ ਵਿੱਚ ਸਾਡ ਮੇਰੀ ਬੇਟੀ ਦਾ ਬਰਡੇ ਪਾਰਟੀ ਔਰਗਨਾਈਜ ਕੀਤੀ ਗਈ ਹੈ ਜਿਸ ਸਬੰਧੀ ਸਾਨੂੰ ਕੁਝ ਰਿਕੁਆਇਰਮੈਂਟ ਕੁਝ ਖਾਣ ਵਾਲੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਕਿ ਬਰਡੇ ਕੇਕ ਸਪਰਿੰਗ ਰੋਲ ਚੀਜ਼ ਚਿੱਲੀ ਨਿਊਡਲਸ ਕੋਲਡ ਡਰਿੰਕ ਅਤੇ ਤੀਹ ਬ ਤੀਹ ਜਣਿਆਂ ਦਾ ਲੰਚ ਜਿਸ ਵਿੱਚ ਮਿਕਸ ਵੈਜ ਸ਼ਾਹੀ ਪਨੀਰ ਦਾਲ ਮੱਖਣੀ ਪਲੇਨ ਰਾਇਤਾ ਬਟਰ ਨਾਨ ਅਤੇ ਮਿਕਸ ਚਪਾਤੀ ਦੀ ਜ਼ਰੂਰਤ ਹੈ ਇਸ ਸਬੰਧੀ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਸਮਾਗਮ ਪਰਸੋਂ ਔਰਗਨਾਈਜ ਕੀਤਾ ਗਿਆ ਹੈ ਕੀ ਤੁਸੀਂ ਸਮੇਂ ਸਿਰ ਇਹ ਔਡਰ ਪ੍ਰਦਾਨ ਕਰ ਸਕਦੇ ਹੋ ਜੇ ਕਰ ਸਕਦੇ ਹੋ ਤਾਂ ਇਸ ਔਡਰ ਸਬੰਧੀ ਤੁਸੀਂ ਸਾਨੂੰ ਕੀ ਔਫਰ ਦੇ ਸਕਦੇ ਹੋ ਇਸ ਵਿੱਚ ਕਿੰਨਾ ਡਿਸਕਾਊਂਟ ਦੇ ਸਕਦੇ ਹੋ ਇਹ ਜੇ ਅਸੀਂ ਔਨਲਾਈਨ ਮੰਗਵਾਉਂਦੇ ਹਾਂ ਕੀ ਤੁਸੀਂ ਸਵੀਗੀ 'ਤੇ ਉਪਲੱਬਧ ਹੋ ਜੇ ਅਸੀਂ ਸਵੀਗੀ ਤੋਂ ਉਪਲੱਬਧ ਕਰਵਾਉਣ ਔਡਰ ਕਰਦੇ ਹਾਂ ਤਾਂ ਸਾਨੂੰ ਕਿੰਨਾ ਡਿਸਕਾਊਂਟ ਕੀਤਾ ਜਾਵੇਗਾ ਇਸ ਸਬੰਧੀ ਤੁਹਾਡਾ ਰੈਸਟੋਰੈਂਟ ਦਾ ਕੀ ਔਫਰ ਹੈ ਅਤੇ ਕੀ ਤੁਹਾਡਾ ਰੈਸਟੋਰੈਂਟ ਸਮੇਂ ਸਿਰ ਇਹ ਔਡਰ ਪ੍ਰਦਾਨ ਕਰਵਾ ਸਕਦਾ ਹੈ ਕਿਰਪਾ ਕਰਕੇ ਇਸ ਸਬੰਧੀ ਮੈਨੂੰ ਜਾਣਕਾਰੀ ਦਿੱਤੀ ਜਾਵੇ